ਸਾਡੇ ਮਹਾਂਵਾਰੀ ਦੌਰਾਨ ਔਰਤਾਂ ਨੂੰ ਪਾਲਣ ਕਰਨ ਲਈ ਕੁਝ ਨਿਯਮ ਹਨ ਜੋ ਕਿ ਉਹਨਾਂ ਨੂੰ ਸਵੱਛ ਰਹਿਣਾ ਚਾਹੀਦਾ ਹੈ ਤੇ ਰੋਜ਼ ਨਹਾਉਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਇਸ ਦੌਰਾਨ ਉਹ ਨਮਾਜ਼ ਨਹੀਂ ਪੜ੍ਹ ਸਕਦੀਆਂ ਨੇ ਅਤੇ ਉਹ ਇਸ ਵਿੱਚ

ਤਸਵੀ ਨੂੰ ਗਿਣ ਸਕਦੀਆਂ ਨੇ ਅਤੇ ਉਹ ਹਰ ਕੰਮ ਕਰ ਸਕਦੀਆ ਨੇ ਅਤੇ ਉਨ੍ਹਾਂ ਨੂੰ ਇਸ ਸਮੇਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਰੈਸਟ ਕਰਨ ਲਈ ਕਿਹਾ ਜਾਂਦਾ ਹੈ ਤਾਂ ਕਿ ਉਹ ਤੰਦਰੁਸਤ ਰਹਿਣ ਅਤੇ ਕਿਸੀ ਬਿਮਾਰੀ ਦਾ ਸ਼ਿਕਾਰ ਨਾ ਹੋਣ ਅਤੇ ਉਹ ਸਵੱਛ ਰਹਿਣ ਅਤੇ ਰੋਜ਼ ਉਹਨਾਂ ਨੂੰ ਨਹਾਉਣ ਦਾ ਪ੍ਰਬੰਧ ਕੀਤਾ ਜਾਂਦਾ ਹੈ